ਹੁਣ ਇੰਟਰਨੈਟ ਚੱਲ ਪਿਆ ਸਾਨੂੰ ਇੰਟਰਨੈਟ ਦੀ ਬਹੁਤ ਸੁਵਿਧਾ ਹੋ ਚੁੱਕੀ ਹੈ ਜੋ ਕਿ ਬੈਂਕ ਦੀਆਂ ਸਕੀਮਾਂ ਵਗੈਰਾ ਬੈਂਕ ਦੀ ਕੋਈ ਵੀ ਜਾਣਕਾਰੀ ਹੈ ਅਤੇ ਛੁੱਟੀ ਹੈ ਤਾਂ ਕੋਈ ਵੀ ਸਕੀਮ ਆਉਂਦੀ ਹੈ ਬੈਂਕ ਤੋਂ ਸਾਨੂੰ ਇੰਟਰਨੈੱਟ ਰਾਹੀਂ ਸਾਨੂੰ ਪਹਿਲਾਂ ਹੀ ਪਤਾ ਚੱਲ ਜਾਂਦੀ ਹੈ ਨਹੀਂ ਤਾਂ ਪਹਿਲਾਂ ਦੇ ਜ਼ਮਾਨੇ ਅਖਬਾਰ ਦੀ ਵੇਟ ਕਰਨੀ ਪੈਂਦੀ ਸੀ ਸਾਨੂੰ ਜੋ ਕਿ ਹੁਣ ਇੰਟਰਨੈੱਟ ਰਾਹੀਂ ਬਹੁਤ ਹੀ ਜਲਦੀ ਸਾਨੂੰ ਪਤਾ ਲੱਗ ਜਾਂਦਾ ਹੈ ਬੈਂਕ 'ਚ ਚਾਹੇ ਖਾਤਾ ਖੁਲਵਾਉਣਾ ਹੋਵੇ ਜਾਂ ਕੋਈ ਵੀ ਹੋਰ ਸਕੀਮ ਆਉਂਦੀ ਹੈ ਇਸ ਕਰਕੇ ਸਾਨੂੰ ਇੰਟਰਨੈੱਟ ਦੀ ਬਹੁਤ ਬਹੁਤ ਹੀ ਸਾਨੂੰ ਸਹੂਲਤ ਮਿਲੀ ਹੈ ਇੰਟਰਨੈਟ ਰਾਹੀਂ ਅਤੇ ਬੈਂਕ ਦੀਆਂ ਕੋਈ ਵੀ ਸਕੀਮਾਂ ਕੁਛ ਵੀ ਹੈ ਸਾਨੂੰ ਸਭ ਕੁਛ ਪਤਾ ਚੱਲਦਾ ਹੈ ਇੰਟਰਨੈੱਟ ਰਾਹੀਂ ਇੰਟਰਨੈੱਟ ਨੇ ਸਾਡੀ ਸਾਡੇ ਵਾਸਤੇ ਬਹੁਤ ਵਧੀਆ ਹੈ ਇੰਟਰਨੈੱਟ ਕੋਈ ਵੀ ਜਾਣਕਾਰੀ ਕੋਈ ਵੀ ਚੀਜ਼